ਜੀ ਹਾਂ ਮੈਂ ਅਮਰਿੰਦਰ ਗਿੱਲ ਜੀ ਨੂੰ ਲਾਈਵ ਸੁਣਿਆ ਹੈ ਉਹ ਇੱਕ ਵਾਰੀ ਸਾਡੇ ਖਾਲਸਾ ਕੋਲਜ ਆਏ ਸਨ ਤਾਂ ਮੈਂ ਉਹਨਾਂ ਨੂੰ ਲਾਈਵ ਸੁਣਨ ਦਾ ਮੌਕਾ ਮਿਲਿਆ ਲਾਈਵ ਸੁਣਨਾ ਇੱਕ ਬਹੁਤ ਹੀ ਵਧੀਆ ਅਨੁਭਵ ਸੀ ਅਸੀਂ ਉਸ ਬੰਦੇ ਨੂੰ ਉਸ ਬੰਦੇ ਦੇ ਹਾਓ ਭਾਓ ਉਸ ਬੰਦੇ ਦੀਆਂ ਵਾਈਵਸ ਅਸੀਂ ਆਮੋ ਸਾਹਮਣੇ ਅਨੁਭਵ ਕਰ ਸਕਦੇ ਹਾਂ ਟੀਵੀ ਵਿੱਚ ਉਸ ਬੰਦੇ ਨੂੰ ਸੁਣਨਾ ਅਤੇ ਆਪਣੇ ਸਮੁੱਖ ਉਸ ਬੰਦੇ ਨੂੰ ਸੁਣਨਾ ਬਹੁਤ ਹੀ ਜ਼ਿਆਦਾ ਅੰਤਰ ਹੈ ਲਾਈਵ ਸੁਣ ਕੇ ਮੈਨੂੰ ਬਹੁਤ ਵਧੀਆ ਲੱਗਾ ਅਸੀਂ ਚੀਕ ਚੀਕ ਕੇ ਉਹਨਾਂ ਨੂੰ ਆਪਣੀ ਖੁਸ਼ੀ ਦੱਸ ਰਹੇ ਸਨ ਅਤੇ ਉਹ ਵੀ ਬਹੁਤ ਖੁਸ਼ ਸਨ ਮੈਂ ਅੱਗੇ ਵੀ ਲਾਈਵ ਕਾਰਿਆਕਰਮ ਸੁਣਨਾ ਚਾਹਵਾਂਗੀ ਮੇਰਾ ਬਹੁਤ ਚਿੱਤ ਕਰਦਾ ਹੈ ਕਿ ਮੈਂ ਸੂਫੀ ਸੌਂਗ ਜਿਵੇਂ ਕਿ ਰਾਹਤ ਫਤਿਹ ਅਲੀ ਖਾਨ ਸਾਹਿਬ ਜਾਂ ਹੋਰ ਵੀ ਕਿਸੇ ਸੂਫੀ ਸਿੰਗਰ ਦਾ ਲਾਈਵ ਗਾਣਾ ਸੁਣਾਂ ਤਾਂ ਜੋ ਮੇਰੀ ਰੂਹ ਨੂੰ ਸ਼ਾਂਤੀ ਮਿਲੇ ਧੰਨਵਾਦ